ਸਲਵਾਰ ਦੀਆਂ ਮੋਰੀਆਂ ਦੇ ਡਿਜ਼ਾਇਨ ਡਿਜ਼ਾਇਨ ਕਈ ਤਰ੍ਹਾਂ ਦੇ ਹੁੰਦੇ ਹਨ ਜਿਗ ਜੈਗ ਸਕਰੋਲ ਫਲਾਵਰ ਡਿਜ਼ਾਇਨ ਗੋਟਾ ਪੱਟੀ ਕੱਟ ਵਾਰ ਆਦਿ ਕਈ ਡਿਜਾਇਨ ਹੁੰਦੇ ਹਨ ਮੈਨੂੰ ਕੱਟ ਵਰਕ ਡਿਜਾਇਨ ਬਹੁਤ ਪਸੰਦ ਹੈ ਕੱਟ ਵਰਕ ਡਿਜਾਇਨ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਗੋਲ ਅਤੇ ਤਿਕੋਣਾ ਜਿਹਦੇ ਥੱਲੇ ਰਾਊਂਡ ਸ਼ੇਪ ਅਤੇ ਟਰਾਈਐਂਗਲ ਸ਼ੇਪ ਜਿਹਨੂੰ ਅਸੀਂ ਕਹਿੰਦੇ ਹਾਂ ਅਤੇ ਬੁਕਰਮ ਦੀ ਸਹਾਇਤਾ ਦੇ ਨਾਲ ਕੱਟ ਵਰਕ ਡਿਜ਼ਾਇਨ ਬਣਾਇਆ ਜਾਂਦਾ ਆ ਬੁਕਰਮ 'ਤੇ ਗੋਲ ਡਿਜਾਇਨ ਡਰਾ ਕਰਕੇ ਫਿਰ ਇਹਦੀ ਕਟਾਈ ਕੀਤੀ ਜਾਂਦੀ ਹੈ ਅਤੇ ਕੌਣ ਬੁਕਰਮ ਦੇ ਸਾਇਜ ਦੇ ਅਕੋਰਡਿੰਗ ਕੱਪੜਾ ਦਿੱਤਾ ਜਾਂਦਾ ਹੈ ਅਤੇ ਕੱਪੜੇ ਦੇ ਸਿੱਧੇ ਪਾਸੇ ਨੂੰ ਜੋੜ ਦਿੱਤਾ ਜਾਂਦਾ ਹੈ ਕੱਪੜੇ 'ਤੇ ਬੁਕਰਮ ਦੇ ਸਿੱਧੇ ਪਾਸੇ ਨੂੰ ਸਿੱਧੀ ਸੀਨ ਮਾਰੀ ਜਾਂਦੀ ਹੈ ਤਾਂ ਕੱਪੜੇ 'ਤੇ ਬੁਕਰਮ ਜੁੜ ਜਾਵੇ ਅਤੇ ਉਸਨੂੰ ਪਲਟ ਕੀਤਾ ਜਾਂਦਾ ਹੈ ਅਤੇ ਕੱਪੜਾ ਸਿੱਧੇ ਪਾਸੇ ਨੂੰ ਦਿਖਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਕਟਿੰਗ ਦੇ ਨਿਸ਼ਾਨ ਹੁੰਦੇ ਹਨ ਉਵੇਂ ਉਵੇਂ ਸੀਨ ਮਾਰੀ ਜਾਂਦੀ ਹੈ ਅਤੇ ਕੱਪੜੇ ਨੂੰ ਫੋਲਡ ਕਰਕੇ ਡਿਜ਼ਾਇਨ ਬਣ ਜਾਂਦਾ ਹੈ ਇਸ ਤਰ੍ਹਾਂ ਸਾਡੀ ਸਲਵਾਰ ਦੀ ਮੋਰੀ ਤਿਆਰ ਹੋ ਜਾਂਦੀ ਹੈ ਕੱਪੜੇ 'ਤੇ ਬੁਕਰਮ ਨੂੰ ਸੈੱਟ ਕਰਨ ਲਈ ਸੈੱਟ ਕਰਨ ਲਈ ਗੋਟਾ ਪੱਟੀ ਦੀ ਹੈਲਪ ਨਾਲ ਡਿਜਾਇਨਿੰਗ ਕੀਤੀ ਜਾਂਦੀ ਹੈ ਇਸ ਤਰ੍ਹਾਂ ਸਾਡੀ ਇਹ ਸਲਵਾਰ ਦੀ ਮੋਰੀ ਤਿਆਰ ਹੋ ਜਾਂਦੀ ਹੈ ਸਾਡੇ ਸਲਵਾਰ ਦਾ ਪੋਂਚਾ ਤਿਆਰ ਹੋ ਜਾਂਦਾ ਹੈ ਫਿਰ ਉਸਨੂੰ ਸਿਲਾਈ ਮਾਰ ਕੇ ਪੂਰੀ ਸਲਵਾਰ ਰੈਡੀ ਕਰ ਦਿੱਤੀ ਜਾਂਦੀ ਹੈ ਧੰਨਵਾਦ